ਸਾਡੇ ਫਾਰਮ ਦੇ ਵਿੱਚ ਬਹੁਤ ਸਾਰੀਆਂ ਕਲਾ ਸ਼ੈਲੀਆਂ ਮੌਜੂਦ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਿਲਪਕਾਰੀ ਵੀ ਹੈ ਜਿਸ ਦੇ ਸ਼ਿਲਪਕਾਰੀ ਅਜਿਹੀ ਕਿਸਮ ਹੈ ਜਿਸ ਦੇ ਵਿੱਚ ਦੀਵਾਰ ਉੱਤੇ ਪੇਂਟਿੰਗ ਕੀਤੀ ਜਾਂਦੀ ਸੀ ਅਤੇ ਉਹ ਬਹੁਤ ਹੀ ਸੋਹਣੀ ਦਿਖਾਈ ਦਿੰਦੀ ਸਨ ਉਸ ਤੋਂ ਬਾਅਦ ਲੋਕਾਂ ਨੇ ਚਟਾਨਾਂ ਦੇ ਉੱਤੇ ਆਰਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਹ ਆਰਟ ਹੌਲੀ ਹੌਲੀ ਕਰਕੇ ਗਾਇਬ ਹੋਣ ਲੱਗ ਗਈ ਫਿਰ ਉਸ ਤੋਂ ਬਾਅਦ ਸਾਡਾ ਹੜੱਪਾ ਦਾ ਜਦੋਂ ਚਾਲੂ ਹੋਇਆ ਸੀਗਾ ਉਸ ਦੇ ਵਿੱਚ ਉਹ ਸ਼ੈਲਸ ਕਾਫੀ ਜਗ੍ਹਾ ਤੋਂ ਮਿਲੇ ਜਿਸ ਦੇ ਵਿੱਚ ਅਲੱਗ ਅਲੱਗ ਆਕਾਰ ਦੀਆਂ ਕਲਾ ਸ਼ੈਲੀਆਂ ਕੀਤੀ ਗਈ ਸਨ ਕੁਛ ਸਮੇਂ ਬਾਅਦ ਇਹ ਕਲਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਫਿਰ ਇਸ ਤੋਂ ਬਾਅਦ ਸਾਨੂੰ ਇਹ ਕਲਾਵਾਂ ਦਾ ਸ਼ੌਕ ਹੀ ਬਹੁਤ ਜ਼ਿਆਦਾ ਹੋ ਗਿਆ ਜਿਸ ਦੇ ਵਿੱਚ ਲੋਕਾਂ ਨੇ ਬਹੁਤ ਹੀ ਜ਼ਿਆਦਾ ਇੰਟਰਸਟ ਲਿਆ ਅਤੇ ਲੋਕਾਂ ਨੇ ਇਹ ਕਲਾ ਸ਼ੈਲੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ